ਇੱਕ ਵਾਰੀ ਇੱਕ ਮੇਰਾ ਦੋਸਤ ਦੀ ਜੁਆਨੀ 'ਚ ਹੀ ਡੈੱਥ ਹੋ ਗਈ ਜੋ ਮੇਰੇ ਦਿਮਾਗ 'ਤੇ ਬਹੁਤ ਭਵੁਕ ਮਹਿਸੂਸ ਹੋਇਆ ਜਿਸ ਦੇ ਕਾਰਨ ਮੈਨੂੰ ਵੀ ਦਿਮਾਗ 'ਚ ਆਇਆ ਕਿ ਉਸ ਦੀ ਵਾਈਫ ਜਵਾਨੀ 'ਚ ਹੀ ਵਿਚਾਰੀ ਉਹ ਵੀਕ ਹੋ ਗਈ ਅਤੇ ਇਸ ਕਰਕੇ ਮੈਂ ਵੀ ਆਪਣੇ ਦਿਲ 'ਚ ਠਾਣ ਲਈ ਕਿ ਮੈਂ ਸੇ ਬੈਂਕਿੰਗ ਦੀ ਸੇਵਿੰਗ ਅਤੇ ਹੈ ਬੀਮਾਂ ਬੀਮੇ ਦੇ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਮੈਂ ਇੱਕ ਚੀ ਲਾਈਫ ਇੰਸ਼ੋਰੈਂਸ ਦੀ ਡਿਲਰਸ਼ਿਪ ਲੈ ਲਈ ਜੋ ਕਿ ਮੈਂ ਲੋਕਾਂ ਨੂੰ ਅਲੱਗ ਅਲੱਗ ਪਲੈਨ ਸਮਝਾ ਕੇ ਉਹਨਾਂ ਦੀ ਲਾਈਫ ਇੰਸ਼ੋਰੈਂਸ ਦੇ ਨਾਲ ਉਹਨਾਂ ਦੀ ਇੱਕ ਸਟਾਰ ਹੈਲਥ ਦੀ ਇੰਸ਼ੋਰੈਂਸ ਵੀ ਦਿਲਚਸਪੀ ਲੈ ਕੇ ਲੋਕਾਂ ਦੀ ਮੈਂ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਮੇਰੇ ਦਿਮਾਗ 'ਚ ਆਇਆ ਹੈ ਕਿ ਮੈਨੂੰ ਵੀ ਖੁਦ ਵੀ ਸੇਵਿੰਗ ਕਰਨੀ ਚਾਹੀਦੀ ਹੈ ਜੋ ਕਿ ਮੈਂ ਵੀ ਇੱਕ ਹੈਲਥ ਇੰਸ਼ੋਰੈਂਸ ਕਰਵਾਈ ਹੈ ਔਰ ਮੈਂ ਬੈਂਕਿੰਗ ਵਿੱਚ ਦੀ ਵੀ ਸੇਵਿੰਗ ਕਰਦਾ ਹਾਂ ਔਰ ਲਾਈਫ ਇਨਸ਼ੋਰੈਂਸ਼ ਵੀ ਮੈਂ ਕਰਵਾ ਰੱਖੀ ਹੈ

ਖੁਦ ਦੇ ਐਕਸਪੀਰੀਅਸ ਦੇ ਨਾਲ ਮੇਰੇ ਕੋਲ ਖੁਦ ਵੀ ਕਾਫੀ ਹੱਦ ਤੱਕ ਸੇਵਿੰਗ ਅਕਾਉਂਟ ਜਮਾਂ ਹੋ ਗਏ ਨੇ ਕਿ ਜਿਸ ਨਾਲ ਮੈਂ ਲੋਕਾਂ ਨੂੰ ਵੀ ਇਹ ਜਾਗਰੂਕ ਕਰਾਉਂਦਾ ਰਹਿੰਦਾ ਹਾਂ ਟਾਈਮ ਤੋਂ ਟਾਈਮ ਇਹ ਤੁਹਾਨੂੰ ਵੀ ਇੱਕ ਲਾਈਫ ਇੰਸ਼ੋਰੈਂਸ ਬੀਮਾਂ ਅਤੇ ਸੇਵਿੰਗ ਵੀ ਕਰਨੀ ਚਾਹੀਦੀ ਹੈ ਜਿਵੇਂ ਕਿ ਕੁਛ ਨਾ ਕੁਛ ਪਲੈਨਿੰਗ ਵੀ ਕਰਨੀ ਚਾਹੀਦੀ ਹੈ ਬੀਮਾਂ ਜਾਂ ਸਿੱਪ ਕੋਈ ਕ ਲਵਾ ਕੇ ਉਹਨਾਂ ਨਾਲ ਸੇਵਿੰਗ ਕੀਤੀ ਜਾ ਸਕਦੀ ਹੈ